ਹੈਲੋ ਹਾਂਜੀ ਕੌਣ ਹਾਂਜੀ ਤੁਸੀਂ ਕੌਣ

ਉਹ ਤਾਂ ਫੇਲ ਆ ਜੀ ਟੈਸਟ ਦੇ ਵਿੱਚ ਤੁਹਾਨੂੰ ਉਹਨੇ ਦਿਖਾਇਆ ਨਹੀਂ ਆਪਣਾ ਟੈਸਟ ਮੈਨੇ ਤਾਂ ਕਿਹਾ ਸੀਗਾ ਸਾਈਨ ਕਰਾ ਕੇ ਲਿਆਇਓ ਆਪਣੇ ਆਪਣੇ ਟੈਸਟ 'ਤੇ ਉਹਨੇ ਤੁਹਾਡਾ ਸਾਈਨ ਵੀ ਕਰਿਆ ਹੋਇਆ ਸੀ ਨਹੀਂ ਫਿਰ ਉਹ ਇਸਦਾ ਮਤਲਬ ਆਪ ਸਾਈਨ ਕਰਕੇ ਗਿਆ ਉਹ ਹਾਂਜੀ ਜ਼ਰੂਰ ਅਤੇ ਟੈਸਟ ਤਾਂ ਉਹਦਾ ਬਹੁਤ ਜ਼ਿਆਦਾ ਖ਼ਰਾਬ ਹੋਇਆ ਫੇਲ ਆ ਉਹ ਟੈਸਟ ਚੋਂ ਨਹੀਂ ਸਰ ਕਲਾਸ 'ਚ ਤਾਂ ਉਹ ਕਦੀ ਕਦੀ ਓ ਆਂਦਾ ਨਾਲੇ ਅਤੇ ਨਾਲੇ ਪਿੱਛੇ ਬੈਠਾ ਰਹਿੰਦਾ ਹੈ ਗੱਲਾਂ ਮਾਰਦਾ ਰਹੇਗਾ ਨਹੀਂ ਉਹਨੂੰ ਸਮਝਾਓ ਤੁਸੀਂ ਟਿਊਟਰ ਰੱਖਣ ਨਾਲ ਕਿਹੜਾ ਕੁਛ ਹੋਣ ਲੱਗਿਆ ਤੁਸੀਂ ਉਹਨੂੰ ਸਮਝਾਓ ਪਿਆਰ ਨਾਲ ਸਮਝਾਓ ਉਹਨੂੰ ਕਿਵੇਂ ਸਮਝਦਾ ਉਹ ਨਹੀਂ ਪਹਿਲਾਂ ਤਾਂ ਟੀਚਰ ਮਾਪੇ ਹੀ ਹੁੰਦੇ ਹੈ ਨਾ ਜੀ ਹਾਂਜੀ ਫਿਰ ਸਮਝਾਓ ਉਹਨੂੰ ਅਸੀਂ ਤਾਂ ਜਿੰਨਾ ਕਰਦੇ ਹਾਂ ਉਹ ਨਾ ਜਿੰਨਾ ਕਰ ਸਕਦੇ ਹਾਂ ਉਨਾਂ ਤਾਂ ਕਰਦੇ ਹਾਂ ਅਸੀਂ ਘਰ 'ਤੇ ਤਾਂ ਤੁਹਾਨੂੰ ਹੀ ਦੇਖਣੀ ਹੈ ਕਿ ਕਿਵੇਂ ਰੱਖਣਾ ਉਹਨੂੰ ਬੱਚੇ ਨੂੰ ਕਿਵੇਂ ਸਮਝਾਉਣਾ ਕੀ ਕਰਨਾ ਕੀ ਨਹੀਂ ਜਦੋਂ ਉਹਨੂੰ ਪੜ੍ਹਨ ਨੂੰ ਕਹਿ ਦਿਉ ਉਸ ਕੋਲ ਕੋਈ ਕਿਤਾਬ ਨਹੀਂ ਹੁੰਦੀ ਉਹਨੂੰ ਕਿੰਨੀ ਵਾਰ ਅੱਗੇ ਬਿਠਾਇਆ ਹੈ ਉਹਨੂੰ ਕਿੰਨੀ ਵਾਰੀ ਬਿਠਾਇਆ ਅਗਲੇ ਪੀਰੀਅਡ ਫਿਰ ਪਿੱਛੇ ਚਲ ਜਾਂਦਾ ਉਹ ਮੈਨੂੰ ਕਿੰਨੇ ਟੀਚਰਾਂ ਤੋਂ ਉਹਦੀ ਕੰਪਲੇਂਟ ਆ ਗਈ ਨਹੀਂ ਤੁਸੀਂ ਉਹਨੂੰ ਸਮਝਾਓ ਨਾ ਹਾਂ ਵੀ ਤੁਹਾਡੇ ਟੀਚਰ ਦੀ ਕੰਪਲੇਂਟ ਆਈ ਹੈ ਹੁਣ ਐਵੇਂ ਐਵੇਂ ਕਰਕੇ ਹਾਂਜੀ ਸ਼ਰਾਰਤਾਂ ਤਾਂ ਬਹੁਤ ਕਰਦਾ ਜੀ ਇੱਕ ਤਾਂ ਇਹ ਕਲਾਸ 'ਚ ਨਹੀਂ ਵੜਦਾ ਹਰ ਟਾਇਮ ਇਹਨੂੰ ਦੇਖੋ ਬਾਹਰ ਹੋਏਗਾ ਜਿੱਥੇ ਤੁਸੀਂ ਕਲਾਸ ਦੇਖ ਲਓ ਉੱਥੇ ਬਾਹਰ ਹੋਏਗਾ ਇਹ ਕਲਾਸ ਕਦੀ ਲਾਉਂਦਾ ਹੀ ਨਹੀਂ ਹੈਗਾ ਇਹ ਪ੍ਰੋਪਰ ਕਦੀ ਵੀ ਜੇ ਕਲਾਸ ਲਾ ਰਿਹਾ ਹੋਏਗਾ ਉਸ ਟੈਮ ਇਹਦਾ ਧੁ ਧਿਆਨ ਹੋਰ ਕਿਤੇ ਹੋਏਗਾ ਕਲਾਸ ਕਿਤੇ ਲਾ ਰਹੀ ਲੱਗ ਰਹੀ ਹੁੰਦੀ ਆ ਜੇ ਇਹਨੂੰ ਕੋਈ ਪੁੱਛਲੋ ਕੁਛ ਆਉਂਦਾ ਨਹੀਂ ਹੁੰਦਾ ਇਹਨੂੰ ਹਾਂਜੀ ਠੀਕ ਹੈ ਜੀ ਠੀਕ